ਮੈਂ ਆਪਣੇ ਦਿਨ ਚਰਿਆ ਵਿੱਚ ਰਸਾਲੇ ਅਖ਼ਬਾਰ ਬਲੋਗ ਸਭ ਕੁਛ ਪੜ੍ਹਦਾ ਹਾਂ ਪਰ ਮੈਨੂੰ ਬਲੋਗ ਪੜ੍ਹਨਾ ਕੁਛ ਜ਼ਿਆਦਾ ਹੀ ਪਸੰਦ ਹੈ ਖਾਸ ਕਰਕੇ ਤਕਨੀਕੀ ਬਲੋਗ ਉਹਨਾਂ ਕੋਲ ਹਮੇਸ਼ਾਂ ਗੈਜ਼ਿਟਸ ਸੋਫਟਵੇਅਰ ਅਤੇ ਕੁਛ ਰੋਜ਼ਾਨਾ ਬਾਰੇ ਨਵੀਨਤਮ ਖਬਰਾਂ ਅਤੇ ਸੁਝਾਵ ਹੁੰਦੇ ਹਨ ਮੈਂ ਨਵੀਆਂ ਚੀਜ਼ਾਂ ਸਿੱਖਣਾ ਅਤੇ ਵਧੀਆ ਚੀਜ਼ਾਂ ਖੋਜਣਾ ਪਸੰਦ ਕਰਦਾ ਹਾਂ ਜੋ ਮੈਂ ਆਪਣੇ ਦੋਸਤਾਂ ਨਾਲ਼ ਵਰਤ ਸਕਦਾ ਹਾਂ ਜਾਂ ਸਾਂਝਾ ਕਰ ਸਕਦਾ ਹਾਂ ਮੇਰਾ ਮਨਪਸੰਦ ਬਲੋਗ ਤਕਨੀਕੀ ਬਲੋਗ ਹੈ ਕਿਉਂਕਿ ਇਸ ਵਿੱਚ ਬਹੁਤ ਸਾਰੇ ਵਿਭਿੰਨਤਾ ਅਤੇ ਗੁਣਵੱਤਾ ਵਾਲੀ ਸਮੱਗਰੀ ਹੈ ਇਹ ਗੇਮਿੰਗ ਏ ਆਈ ਸਾਈਬਰ ਸੁਰੱਖਿਆ ਅਤੇ ਹੋਰ ਇਸ ਵਰਗੇ ਵਿਸ਼ਿਆਂ ਨੂੰ ਕਵਰ ਕਰਦਾ ਹੈ ਲੇਖਕ ਗਿਆਨਵਾਨ ਅਤੇ ਮਜ਼ਾਕੀਆ ਹੈ ਅਤੇ ਉਹ ਹਮੇਸ਼ਾਂ ਮੈਨੂੰ ਉਤਸੁਕ ਅਤੇ ਮਨੋਰੰਜਨ ਕਰਦੇ ਹਨ ਮੈਂ ਹਰ ਰੋਜ਼ ਤਕਨੀਕੀ ਬਲੋਗ ਦੀ ਜਾਂਚ ਕਰਦਾ ਹਾਂ ਅਤੇ ਮੈਂ ਕਦੇ ਵੀ ਇਸ ਨੂੰ ਪੜ੍ਹਦੇ ਹੋਏ ਬੋਰ ਨਹੀਂ ਹੁੰਦਾ ਇਹ ਮੈਨੂੰ ਹਮੇਸ਼ਾਂ ਰੋਜ਼ਾਨਾ ਜ਼ਿੰਦਗੀ ਵਿੱਚ ਨਵੀਆਂ ਨਵੀਆਂ ਤਕਨੀਕਾਂ ਬਾਰੇ ਦੱਸਦਾ ਰਹਿੰਦਾ ਹੈ